ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਕਿੰਨੇ ਬੱਚੇ ਆ ਜੀ ਅੱਛਾ ਕੀ ਕੀ ਕਰਵਾਉਣਾ ਬੇਟੇ ਆਪਣੇ ਕੋਲ ਬਹੁਤ ਸਾਰੀਆਂ ਬੇਟਾ ਕ੍ਰਿਕਟ ਹੋ ਗਿਆ ਬੋਲੀਬਾਲ ਹੋ ਗਿਆ ਖੋ ਖੋ ਹੋ ਗਈ ਕਰਾਟੇ ਹੋ ਗਏ ਤੁਸੀਂ ਦੱਸੋ ਕਿਹੜੇ ਸਿੱਖਣਾ ਚਾਹੁੰਦੇ ਹੋ ਹੈਗੀ ਆ ਹੈਗੀ ਉਹ ਵੀ ਹੈਗਾ ਤੁਸੀਂ ਕਿੱਥੋਂ ਬੋਲਦੇ ਹੋ ਕੋਈ ਗੱਲ ਨਹੀਂ ਵੀ ਤੁਸੀਂ ਨਾ ਜੀ ਤੁਸੀਂ ਸਿੱਖਣੀ ਹੈ ਕਿ ਬੱਚਿਆਂ ਨੂੰ ਸਿਖਾਉਣੀ ਹੈ ਤੁਸੀਂ ਇੱਕ ਦਿਨ ਆਪਣੇ ਇੱਧਰ ਕਲੱਬ 'ਚ ਲੈ ਕੇ ਆਓ ਬੱਚਿਆਂ ਨੂੰ ਉਹਨਾਂ ਨੂੰ ਸਾਰਾ ਕੁਝ ਚੀਜ਼ਾਂ ਦਿਖਾਵਾਂਗੇ ਆਪਾਂ ਇੱਕ ਦੋ ਦਿਨ ਊ ਲਗਾ ਲੈਣ ਟਾਈਮਿੰਗ ਆਪਣਾ ਮੋਰਨਿੰਗ ਅੱਠ ਵਜੇ ਸਟਾਰਟ ਹੋ ਜਾਂਦਾ ਅਤੇ ਸ਼ਾਮ ਨੂੰ ਸੱਤ ਵਜੇ ਤੱਕ ਤਕਰੀਬਨ ਲਾਸਟ ਸੱਤ ਵਜੇ ਨੂੰ ਆਪਾਂ ਕਲੋਜ ਕਰ ਦਿੰਦੇ ਹਾਂ ਪੰਜ ਵਜੇ ਵਾਲਾ ਓ ਪੰਜ ਵਜੇ ਵਾਲਾ ਜੀ ਚੱਲੋ ਭੇਜ ਦਿਆ ਕਰੋ ਹਾਂ ਹਾਂ ਹੈਗਾ ਹੈਗਾ ਉਹਦਾ ਅਲੱਗ ਚਾਰਜ ਲੱਗੂਗਾ ਜੀ ਹੂੰ ਸਭ ਕੁਛ ਸਿਖਾਵਾਂਗੇ ਤੁਸੀਂ ਇੱਕ ਵਾਰ ਬੱਚਿਆਂ ਨੂੰ ਡੈਮੋ ਕਲਾਸ ਦਿਖਾਓ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਮਨ ਫਿਰ ਬ ਬਣੂਗਾ ਬਹੁਤ ਵਧੀਆ ਆਪਣੇ ਕੋਲ ਹੈਗਾ ਹੈਗਾ ਸਭ ਕੁਛ ਅੱਛਾ ਉਹ ਆਪਣਾ ਕੀ ਨਾਂ ਮੁੰਡੇ ਦਾ ਹਾਂ ਹਾਂ ਹਾਂ ਹਾਂ ਹਾਂ ਹਾਂ ਉਹ ਮੁੰਡੇ ਲੱਗੇ ਵੇ ਕਾਫ਼ੀ ਸਮੇਂ ਦੇ ਆਪਣੇ ਹਾਂਜੀ ਹਾਂਜੀ ਇਹ ਤਾਂ ਬੱਚਿਆਂ ਨੂੰ ਜ਼ਿਆਦਾ ਬੁਰੀ ਬਿਮਾਰੀ ਆ ਹਾਂ ਹਾਂ ਇਹ ਤਾਂ ਗੱਲ ਹੈਗੀ ਹੈ ਜੀ ਹਾਂਜੀ ਹਾਂਜੀ ਹਾਂਜੀ